ਸਾਡੇ ਰਾਜ ਪੰਜਾਬ ਦਾ ਪਹਿਰਾਵਾ ਸਭ ਰਾਜਾਂ ਤੋਂ ਵੱਖਰਾ ਹੈ ਅਸੀਂ ਖਾਣ ਅਤੇ ਪਾਉਣ ਦੇ ਬਹੁਤ ਸ਼ਕੀਨ ਹਾਂ ਜਿੱਥੇ ਸੂਟ ਸਲਵਾਰ ਕੁੜਤਾ ਚਾਦਰਾ ਸਾਡੇ ਸੱਭਿਆਚਾਰ ਦੀ ਸ਼ਾਨ ਮੰਨੀ ਜਾਂਦੀ ਹੈ ਉੱਥੇ ਇਸ ਪਹਿਰਾਵੇ ਵਿੱਚ ਗਹਿਣੇ ਵੀ ਵੱਡਾ ਰੋਲ ਅਦਾ ਕਰਦੇ ਹਨ ਜੇ ਚਾਦਰੇ ਦੇ ਨਾਲ ਕੈਂਠਾ ਪਾਇਆ ਹੋਵੇ ਅਤੇ ਜੱਟੀਆਂ ਨੇ ਸੂਟ ਸ ਨਾਲ ਪਿੱਪਲ ਪੱਤੀਆਂ ਪਾਈਆਂ ਹੋਣ ਤਾਂ ਉਹਨਾਂ ਨੂੰ ਵੇਖਣ ਦਾ ਨਜ਼ਾਰਾ ਹੀ ਹੋਰ ਹੈ ਆਧੁਨਿਕਤਾ ਦੇ ਨਾਲ ਸਾਡਾ ਪਹਿਰਾਵਾ ਭਾਵੇਂ ਨਵਾਂ ਰੂਪ ਲੈ ਚੁੱਕਿਆ ਚੁੱਕਿਆ ਹੈ ਪਰ ਅਜੇ ਵੀ ਉਸ ਪਹਿਰਾਵੇ ਵਿੱਚ ਸਾਡੇ ਸੱਭਿਆਚਾਰ ਦੀ ਝਲਕ ਤਾਂ ਕਿਤੇ ਨਾ ਕਿਤੇ ਮਿਲ ਹੀ ਜਾਂਦੀ ਹੈ ਅੱਜ ਜਿਸ ਬੰਦੇ ਨੇ ਪੈਂਟ ਕੋਟ ਪਾਇਆ ਹੋਵੇ ਅਸੀਂ ਉਸ ਮੰਨਦੇ ਹਾਂ ਕਿ ਉਹ ਬਹੁਤ ਪੜ੍ਹਿਆ ਲਿਖਿਆ ਹੋਵੇਗਾ ਅਤੇ ਕੁੜਤੇ ਪਜਾਮੇ ਵਾਲੇ ਨੂੰ ਅਨਪੜ੍ਹ ਗਵਾਰ ਮਨ ਵਾਂਗ ਹੀ ਵੇਖਿਆ ਜਾਂਦਾ ਹੈ ਪਰ ਕੋਈ ਕੱਪੜਾ ਕਦੇ ਸਾਡੇ ਅਸਤਿਤਵ ਨੂੰ ਨਹੀਂ ਬਣਾ ਸਕਦਾ ਸਾਨੂੰ ਆਪਣੇ ਸੱਭਿਆਚਾਰਕ ਪਹਿਰਾਵੇ ਨੂੰ ਨਹੀਂ ਭੁੱਲਣਾ ਚਾਹੀਦਾ ਪਹਿਰਾਵਾ ਹਰ ਰਾਜ ਦਾ ਉੱਥੇ ਦੇ ਵਾਤਾਵਰਨ ਅਤੇ ਲੋਕਾਂ ਦੇ ਅਨੁਸਾਰ ਹੀ ਹੁੰਦਾ ਹੈ ਪਰ ਅੱਜ ਟੀ ਵੀ ਸਿਨੇਮਾ ਯੂਟਿਊਬ ਨੂੰ ਲੋਕਾਂ ਦਾ ਦਿਮਾਗ ਖ਼ਰਾਬ ਕਰ ਦਿੱਤਾ ਹੈ